ਮੈਂ ਆਪਣੇ ਘਰ ਵਿੱਚ ਵੱਖ ਵੱਖ ਪਕਵਾਨ ਬਣਾਉਂਦੀ ਹਾਂ ਕਿਉਂਕਿ ਮੈਨੂੰ ਵੱਖ ਵੱਖ ਪਕਵਾਨ ਬਣਾਉਣੇ ਬਹੁਤ ਚੰਗੇ ਲੱਗਦੇ ਹਨ ਇਸ ਲਈ ਮੈਂ ਤੁਹਾਡੇ ਲਈ ਦੋ ਪਕਵਾਨਾਂ ਦਾ ਅਨੁਭਵ ਵਰਣਨ ਕਰਨਾ ਚਾਹੁੰਦੀ ਹਾਂ ਮੈਂ ਆਪਣੇ ਬੱਚਿਆਂ ਲਈ ਇੱਕ ਵਾਰੀ ਪ੍ਰਸ਼ਾਦ ਬਣਾਇਆ ਸੀ ਪ੍ਰਸ਼ਾਦ ਬਣਾਉਣ ਵਿੱਚ ਮੈਨੂੰ ਕੋਈ ਵੀ ਦਿੱਕਤ ਨਹੀਂ ਆਈ ਕਿਉਂਕਿ ਪ੍ਰਸ਼ਾਦ ਬਹੁਤ ਹੀ ਜਲਦੀ ਬਣ ਜਾਂਦਾ ਹੈ ਅਤੇ ਬੱਚੇ ਵੀ ਬਹੁਤ ਖੁਸ਼ ਹੋ ਕੇ ਪ੍ਰਸ਼ਾਦ ਖਾਂਦੇ ਹਨ ਅਤੇ ਉਹ ਕਹਿੰਦੇ ਮੰਮਾ ਤੁਸੀਂ ਪ੍ਰਸ਼ਾਦ ਬਹੁਤ ਵਧੀਆ ਬਣਾਇਆ ਹੈ ਇੱਕ ਦਿਨ ਮੈਂ ਆਪਣੇ ਬੱਚਿਆਂ ਲਈ ਲੂਣ ਵਾਲੇ ਚਾਵਲ ਬਣਾਏ ਉਹਨਾਂ ਨੂੰ ਬਣਾਉਣ ਵਿੱਚ ਮੈਨੂੰ ਬਹੁਤ ਹੀ ਸਮਾਂ ਲੱਗਿਆ ਅਤੇ ਬੱਚੇ ਵੀ ਬਹੁਤ ਛੋਟੇ ਹਨ ਇਸ ਕਰਕੇ ਉਹ ਬਹੁਤ ਕਾਹਲ ਕਰਦੇ ਹਨ ਉਹ ਕਹਿੰਦੇ ਮੰਮਾ ਜਲਦੀ ਬਣਾਓ ਕਿਉਂਕਿ ਸਾਨੂੰ ਬਹੁਤ ਭੁੱਖ ਲੱਗੀ ਹੈ ਇਸ ਲਈ ਉਹਨਾਂ ਨੇ ਬਹੁਤ ਹੀ ਜ਼ੋਰ ਜ਼ੋਰ ਦੀ ਕਹਿਣ ਲੱਗੇ ਅਤੇ ਫੇਰ ਮੈਂ ਮੈਨੂੰ ਪ੍ਰਸ਼ਾਦ ਬਣਾਉਣਾ ਬਹੁਤ ਚੰਗਾ ਲੱਗਿਆ ਕਿਉਂਕਿ ਉਸ ਵਿੱਚ ਸਮਾਂ ਘੱਟ ਲੱਗਦਾ ਹੈ ਪ੍ਰਸ਼ਾਦ ਨੂੰ ਬਣਾਉਣ ਵਿੱਚ ਸਮਾਂ ਬਹੁਤ ਹੀ ਜ਼ਿਆਦਾ ਲੱਗਦਾ ਹੈ ਥੈਂਕ ਯੂ